ਗੁਰਦਾਸਪੁਰ ਜ਼ਿਲ੍ਹੇ ਵਿੱਚ ਸਿੱਖਿਆ ਲਈ ਸਰਕਾਰ ਨੇ ਕਈ ਸਕੂਲ ਕਾਲਜ ਖੁੱਲ੍ਹਵਾਏ ਹਨ ਹਰ ਪਿੰਡ ਸ਼ਹਿਰ ਵਿੱਚ ਬੱਚੇ ਖੁੱਲ੍ਹੇ ਹਨ ਜਿਸ ਕਰਕੇ ਇੱਕ ਹਰ ਇੱਕ ਨੂੰ ਸਿੱਖਿਆ ਦੇ ਮੌਕੇ ਮਿਲਦੇ ਹਨ ਸਰਕਾਰੀ ਸਕੂਲ ਵਿੱਚ ਗਰੀਬ ਬੱਚਾ ਬੱਚੇ ਪੜ੍ਹਦੇ ਹਨ ਉਹਨਾਂ ਨੂੰ ਸਰਕਾਰ ਵੱਲੋਂ ਵਜ਼ੀਫੇ ਵੀ ਦਿੱਤੇ ਜਾਂਦੇ ਹਨ ਤਾਂ ਕਿ ਉਹ ਆਪਣੀ ਪੜ੍ਹਾਈ ਪੂਰੀ ਕਰ ਸਕਣ ਰੁਜ਼ਗਾਰ ਦੇ ਮਾਮਲੇ ਵਿੱਚ ਗੁਰਦਾਸਪੁਰ ਕਾਫੀ ਫੈਕਟਰੀਆਂ ਅਤੇ ਕੰਪਨੀਆਂ ਹਨ ਜਿੱਥੇ ਹਰ ਇੱਕ ਨੌਜਵਾਨ ਨੂੰ ਰੁਜ਼ਗਾਰ ਦਾ ਮੌਕਾ ਮਿਲਦਾ ਆ ਸਰਕਾਰ ਦੀਆਂ ਕਈ ਪਾਰਟੀਆਂ ਨੂੰ ਚਲਾਉਣ ਵਾਸਤੇ ਕਈ ਜਥੇਬੰਦੀਆਂ ਅਤੇ ਪਾਰਟੀਆਂ ਹਨ ਨੌਜਵਾਨ ਉਹਨਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ ਇਹਨਾਂ ਹੀ ਪਾਰਟੀਆਂ ਵਿੱਚ ਕਈ ਲੀਡਰ ਵੀ ਹਨ ਜੋ ਵਿਕਾਸ ਦਾ ਕੰਮ ਕਰ ਕਾਰ ਕਰਦੇ ਪਏ ਹਨ ਗੁਰਦਾਸਪੁਰ ਜ਼ਿਲ੍ਹਾ